ਨਹੀਂ ਮੈਨੂੰ ਕਦੇ ਵੀ ਪੰਜਾਬੀ ਵਿੱਚ ਲਿਖਣ ਜਾਂ ਬੋਲਣ ਸਮੇਂ ਕੋਈ ਵੀ ਮੁਸ਼ਕਲ ਜਾਂ ਦਿੱਕਤ ਨਹੀਂ ਆਈ ਹੈ ਕਿਉਂਕਿ ਸਾਨੂੰ ਪਤਾ ਅਸੀਂ ਪੰਜਾਬ ਦੇ ਰਹਿਣ ਵਾਲੇ ਵਾਸੀ ਹਾਂ ਅਤੇ ਸਾਨੂੰ ਸਾਡੀ ਜਿਹੜੀ ਮਾਤ ਭਾਸ਼ਾ ਸਾਡੀ ਜਿਹੜੀ ਮਾਂ ਬੋਲੀ ਹੈ ਅਸੀਂ ਜਿਹੜੇ ਆਪਦੀ ਮਾਂ ਕੋਲੋਂ ਸਿੱਖਦੇ ਹਾਂ ਉਸ ਪੰਜਾਬੀ ਹੀ ਹੈ ਅਸੀਂ ਪੰਜਾਬ ਪੰਜਾਬੀ ਨੂੰ ਸਿੱਖਣਾ ਉਹਨੂੰ ਹੀ ਮਤਲਬ ਬੋਲਣਾ ਜ਼ਿਆਦਾ ਪ੍ਰੈਫਰ ਕਰਦੇ ਹਾਂ ਕਿਉਂਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਕਿ ਜਦੋਂ ਵੀ ਮੈਂ ਕਿਤੇ ਬਾਹਰ ਜਾਵਾਂ ਅਤੇ ਆਪਦੇ ਸੱਭਿਆਚਾਰ ਨੂੰ ਦਿਖਾਵਾਂ ਉੱਥੇ ਜਾ ਕੇ ਆਪਦੀ ਭਾਸ਼ਾ ਬੋਲਾਂ ਮੈਨੂੰ ਬੜਾ ਮ ਮਾਣ ਮਹਿਸੂਸ ਹੁੰਦਾ ਕਿ ਜਦੋਂ ਮੈਂ ਆਪਦੀ ਪੰਜਾਬੀ ਭਾਸ਼ਾ 'ਚ ਲਿਖਦੀ ਹਾਂ ਜਾਂ ਬੋਲਦੀ ਹਾਂ ਮੈਨੂੰ ਬੜਾ ਪਸੰਦ ਹੈ ਇਹਦੇ ਅੱਖਰ ਜਾਂ ਫੇਰ ਬੋਲ ਇਹਦੇ ਪੰਜਾਬੀ ਵਿੱਚ ਬੋਲਣਾ ਅਤੇ ਹੋਰ ਵੀ ਮਤਲਬ ਪਰ ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਹੜੇ ਬੱਚੇ ਹਨ ਉਹਨਾਂ ਉਹ ਪੰਜਾਬੀ ਨੂੰ ਭੁੱਲ ਹੀ ਚੁੱਕੇ ਹਨ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬੀ 'ਚ ਜੇ ਕੋਈ ਉਹਨਾਂ ਨੂੰ ਕੁਛ ਵੀ ਬੋਲ ਦਿੰਦਾ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਸਿਰਫ ਇੰਗਲਿਸ਼ ਹੀ ਸਿੱਖਣਾ ਜ਼ਿਆਦਾ ਪ੍ਰੈਫਰ ਕਰਦੇ ਹਨ ਉਹਨਾਂ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਸੈਕਿੰਡ ਜਾਂ ਫਸਟ ਕਲਾਸ ਤੋਂ ਪੰਜਾਬੀ ਲਗਾਈ ਜਾਂਦੀ ਹੈ ਬਲਕਿ ਐਵੇਂ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਦੀ ਮਾਂ ਬੋਲੀ ਸਿਖਾਉਣੀ ਚਾਹੀਦੀ ਹੈ ਪਰ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੁਰੂ ਤੋਂ ਹੀ ਇੰਗਲਿਸ਼ ਅੰਗਰੇਜ਼ਾਂ ਦੀ ਭਾਸ਼ਾ ਸਿਖਾਈ ਜਾਂਦੀ ਹੈ ਜਿਹਦੇ ਕਰਕੇ ਅੱਜ ਕੱਲ੍ਹ ਦੇ ਬੱਚੇ ਵੀ ਇੰਗਲਿਸ਼ 'ਚ ਹੀ ਗੱਲ ਕਰਨਾ ਪਸੰਦ ਕਰਦੇ ਹਨ ਪਰ ਜਿਹੜੀ ਪੰਜਾਬੀ ਆ ਉਹ ਸਾਡੀ ਮਾਂ ਬੋਲੀ ਹੈ ਸਾਨੂੰ ਉਹ 'ਚੋਂ ਬਹੁਤ ਹੀ ਜ਼ਿਆਦਾ ਉਹ 'ਤੇ ਧਿਆਨ ਦੇਣਾ ਚਾਹੀਦਾ ਉਹਨੂੰ ਸਿੱਖਣਾ ਚਾਹੀਦਾ